ਸਾਡੇ ਇਲਾਕੇ ਵਿੱਚ ਖੇਡਾਂ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ ਜਿਸ ਨਾਲ ਹਰ ਕੋਈ ਇਸ ਵੱਲ ਧਿਆਨ ਕਰਕੇ ਰੱਖਦਾ ਹੈ ਸਾਡੇ ਇਲਾਕੇ ਵਿੱਚ ਬਹੁਤ ਹੀ ਹਰਮਨ ਪਿਆਰੇ ਇੱਕ ਪੀ ਟੀ ਟੀਚਰ ਹਨ ਜੋ ਸਾਰਿਆਂ ਨੂੰ ਇਸ ਨਾਲ ਜੋੜ ਕੇ ਰੱਖਦੇ ਹਨ ਅਤੇ ਸਾਡੇ ਸਟੇਡੀਅਮ ਬਣਿਆ ਹੋਇਆ ਹੈ ਉਸ ਵਿੱਚ ਹਰੇਕ ਨੂੰ ਉਹ ਸਿਖਲਾਈ ਦਿੰਦੇ ਹਨ ਅਸੀਂ ਹਰ ਕਿਸੇ ਨੂੰ ਆਪਣੇ ਭੈਣ ਭਰਾ ਦੋਸਤ ਮਿੱਤਰ ਨੂੰ ਇਹੋ ਹੀ ਸਲਾਹ ਦੇਣੀ ਚਾਹੁੰਦੇ ਹਾਂ ਵੀ ਜੇ ਕਿਸੇ ਨੇ ਕਿਸੇ ਕਿਸਮ ਦੀ ਟ੍ਰੇਨਿੰਗ ਲੈਣੀ ਹੋਵੇ ਜਾਂ ਉਸ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ ਅਤੇ ਉਹ ਉਹਨਾਂ ਨੂੰ ਆਣ ਕੇ ਮਿਲ ਸਕਦੇ ਹਨ ਅਤੇ ਉਹ ਹਰੇਕ ਨੂੰ ਇਹੋ ਪ੍ਰੇਰਿਤ ਕਰਦੇ ਹਨ ਵੀ ਜੇ ਕਿਸੇ ਨੇ ਸਿਖਲਾਈ ਲੈਣੀ ਹੈ ਜਾਂ ਕਿਸੇ ਕਿਸਮ ਦਾ ਕੋਈ ਵੀ ਪੀ ਟੀ ਤੌਰ 'ਤੇ ਮਤਲਬ ਵੀ ਆਪਣੀ ਖੇਡਾਂ ਤੌਰ 'ਤੇ ਰੁਚੀ ਵਿਖਾਲਣੀ ਹੈ ਤਾਂ ਉਹ ਆਣ ਕੇ ਉਹਨਾਂ ਨੂੰ ਹਰ ਵਕਤ ਚੌਵੀ ਘੰਟੇ ਉਹ ਆਉਂਦੇ ਸਾਡੇ ਕੋਲ ਸਲਾਹ ਮਸ਼ਵਰਾ ਕਰ ਸਕਦੇ ਹਨ ਬਾਕੀ ਇਹ ਆ ਵੀ ਜੋ ਆਦਮੀ ਇਸ ਲੈਨ ਵਿੱਚ ਰਹੇਗਾ ਉਹ ਵਧੀਆ ਰਹੇਗਾ ਜੇ ਅਗਰ ਜੇ ਕੋਈ ਗਲਤ ਸੰਗਤ ਵਿੱਚ ਪੈ ਗਿਆ ਅਤੇ ਉਸਦਾ ਸਿਹਤ ਦਾ ਨੁਕਸਾਨ ਵੀ ਹੋਵੇਗਾ ਅਤੇ ਉਸ ਦਾ ਪੈਸੇ ਦਾ ਨੁਕਸਾਨ ਵੀ ਹੋਵੇਗਾ